ਰੋਪੜ ਦੇ ਮੌਜੂਦ ਐੱਮ ਐੱਲ ਏ ਸ਼੍ਰੀ ਦਿਨੇਸ਼ ਕੁਮਾਰ ਚੱਢਾ ਜੀ ਹਨ ਜੋ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹਨ ਜਿਨ੍ਹਾਂ ਦੀ ਰਿਹਾਇਸ਼ ਮਕਾਨ ਨੰਬਰ ਇੱਕਾਹਠ ਵੀ ਓ ਪੀ ਵਰਬਾ ਤਹਿਸੀਲ ਅਨੰਦਪੁਰ ਸਾਹਿਬ ਹਲਕਾ ਰੂਪਨਗਰ ਹੈ ਜਿਨ੍ਹਾਂ ਦਾ ਮੋਬਾਇਲ ਨੰਬਰ ਨੜ੍ਹਿਨਵੇਂ ਇੱਕ ਪਚਵੰਜਾ ਸਤੱਤਰ ਨੌਂ ਸੌ ਪੰਜਾਹ ਹੈ ਇਹ ਇੱਕ ਪ੍ਰਸਿੱਧ ਰਾਜਨੀਤਿਕ ਆਗੂ ਹਨ ਜੋ ਦੋ ਹਜ਼ਾਰ ਬਾਈ ਵਿੱਚ ਐੱਮ ਐੱਲ ਏ ਬਣੇ ਸਨ ਜਿਨ੍ਹਾਂ ਨੇ ਉਣਾਹਠ ਹਜ਼ਾਰ ਨੌਂ ਸੌ ਤਿੰਨ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਸੀ ਜਿਨ੍ਹਾਂ ਦੀ ਵੋਟ ਪ੍ਰਤੀਸ਼ਤਤਾ ਚੁਤਾਲੀ ਪੁਆਇੰਟ ਗਿਆਰ੍ਹਾਂ ਪ੍ਰਤੀਸ਼ਤ ਰਹੀ ਸੀ ਇਨ੍ਹਾਂ ਨੇ ਝਾਂਡੀਆਂ ਕਲਾਂ ਖੇਡ ਸਕੇ ਸਟੇਡੀਅਮ ਦਾ ਕੰਮ ਸ਼ੁਰੂ ਕਰਵਾਇਆ ਸੀ ਇਨ੍ਹਾਂ ਨੇ ਨਜਾਇਜ਼ ਮਾਈਨਿੰਗ ਬੰਦ ਕਰਵਾਈ ਸੀ ਇਨ੍ਹਾਂ ਨੇ ਵੱਖਰੇ ਵੱਖਰੇ ਵਿੱਦਿਅਕ ਅਦਾਰਿਆਂ ਵਿੱਚ ਜਾ ਕੇ ਖੇਡ ਮੁਕਾਬਲਿਆਂ ਅਤੇ ਪੜ੍ਹਾਈ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਸਾਈ ਵੀ ਕੀਤੀ ਸੀ ਇਹ ਇੱਕ ਮਿਲਣਸਾਰ ਇਨਸਾਨ ਹਨ ਮੈਂ ਇਹਨਾਂ ਨੂੰ ਆਪਣੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਲੋਕ ਭਲਾਈ ਦੇ ਕੰਮ ਕਰਦਿਆਂ ਬਹੁਤ ਵਾਰ ਦੇਖਿਆ ਹੈ ਇਹ ਧਾਰਮਿਕ ਪ੍ਰੋਗਰਾਮਾਂ ਵਿੱਚ ਬਹੁਤ ਵਾਰ ਸ਼ਾਮਿਲ ਹੋਏ ਹਨ ਜਿਨ੍ਹਾਂ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਇਨ੍ਹਾਂ ਨੇ ਬਜ਼ੁਰਗਾਂ ਦਾ ਸਤਿਕਾਰ ਕਰਨ ਦਾ ਮੁੱਦਾ ਮੁੱਦੇ ਤੇ ਕੰਮ ਕੀਤਾ ਹੈ ਇਨ੍ਹਾਂ ਨੇ ਸਾਡੇ ਨਾਲ ਲੱਗਦੇ ਸ਼ਹਿਰਾਂ ਵਿੱਚ ਬਹੁਤ ਵਾਰ ਮੈਂ ਦੇਖਿਆ ਹੈ ਕਿ ਬਜ਼ੁਰਗਾਂ ਦੇ ਬੈਠਣ ਲਈ ਵੱਖਰੀਆਂ ਵੱਖਰੀਆਂ ਪਾਰਕਾਂ ਅਤੇ ਬੱਚਿਆਂ ਦੇ ਖੇਡਣ ਲਈ ਝੂਟੇ ਵਗੈਰਾ ਲਗਾ ਕੇ ਪ੍ਰਬੰਧ ਕੀਤਾ ਹੈ ਵਿੱਦਿਅਕ ਅਦਾਰਿਆਂ ਵਿੱਚ ਜਾ ਕੇ ਇਹ ਬੱਚਿਆਂ ਨਾਲ ਗੱਲਾਂ ਬਾਤਾਂ ਕਰਕੇ ਬੱਚਿਆਂ ਦੀ ਹੌਂਸਲਾ ਅਫਸਾਈ ਕਰਦੇ ਰਹੇ ਹਨ ਇਨ੍ਹਾਂ ਨੇ ਬੱਚਿਆਂ ਨੂੰ ਨਿੱਜੀ ਤੌਰ 'ਤੇ ਵਜ਼ੀਫਿਆਂ ਦਾ ਪ੍ਰਬੰਧ ਕਰਵਾਇਆ ਹੈ ਬੱਚੇ ਅਤੇ ਬਜੁਰਗ ਇਨ੍ਹਾਂ ਦੇ ਕੰਮ ਤੋਂ ਬਹੁਤ ਖੁਸ਼ ਹਨ ਹੁਣ ਰੋਪੜ ਦੇ ਇਲਾਕੇ ਵਿੱਚ ਨਜਾਇਜ਼ ਮਾਈਨਿੰਗ ਦੇ ਮਸਲੇ ਲਗਾਤਾਰ ਘਟਦੇ ਰਹੇ ਹਨ ਇਨ੍ਹਾਂ ਦੀ ਰਹਿਨੁਮਾਈ ਦੇ ਸਦਕਾ ਸਫਾਈ ਦੇ ਪ੍ਰਬੰਧਾਂ ਵਿੱਚ ਵੀ ਪਹਿਲਾਂ ਨਾਲੋਂ ਕਾਫੀ ਸੁਧਾਰ ਦੇਖਿਆ ਗਿਆ ਹੈ